ਅੱਜ ਦੇ ਸਮੇਂ ਦੇ ਵਿੱਚ ਯੋਗਾ ਸਿੱਖਣ ਲਈ ਬਹੁਤ ਸਾਰੇ ਜਿਹੜੇ ਸਾਧਨ ਉਹ ਮਿਲ ਜਾਂਦੇ ਹਨ ਬਹੁਤ ਸਾਰੇ ਚੈਨਲਾਂ ਉੱਪਰ ਯੋਗਾ ਸਿਖਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਸਭ ਤੋਂ ਵਧੀਆ ਯੋਗਾ ਜਾਂ ਸਭ ਤੋਂ ਜ਼ਿਆਦਾ ਪ੍ਰਚਲਿੱਤ ਹੈ ਬਾਬਾ ਰਾਮਦੇਵ ਜੀ ਦੇ ਚੈਨਲ ਦੇ ਰਾਹੀਂ ਦੇਖ ਸਕਦੇ ਹੋਂ ਅਤੇ ਇਸ ਦੇ ਨਾਲ ਹੀ ਜਦੋਂ ਲੋਕ ਯੋਗਾ ਸਿੱਖਣ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਸਰੀਰਕ ਅਤੇ ਮਾਨਸਿਕ ਤੋਰ 'ਤੇ ਸਥਿਰ ਹੋਣਾ ਬੜਾ ਜ਼ਰੂਰੀ ਹੈ ਜੇਕਰ ਉਹ ਇਸ ਤਰੀਕੇ ਨਾਲ ਸਥਿਰ ਨਹੀਂ ਹੁੰਦੇ ਤਾਂ ਉਹ ਯੋਗੇ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਅਤੇ ਯੋਗਾ ਦਾ ਲਾਭ ਉਠਾਉਣ ਦੀ ਬਜਾਏ ਆਪਣਾ ਨੁਕਸਾਨ ਕਰ ਬੈਠਦੇ ਹਨ ਅਤੇ ਉਹ ਨੁਕਸਾਨ ਕਰਨ ਦੇ ਨਾਲ ਨਾਲ ਬਹੁਤ ਸਾਰੇ ਆਪਣੇ ਜੋੜਾਂ ਦੇ ਵਿੱਚ ਖਿਚਾਅ ਮਹਿਸੂਸ ਕਰਦੇ ਆ ਇਹਨਾਂ ਦੇ ਵਿੱਚ ਉਹ ਆਪਣੇ ਅੰਗਾਂ ਪੈਰਾਂ ਨੂੰ ਆਪਣੀ ਜਗ੍ਹਾ ਤੋਂ ਹਿਲਾ ਬੈਠਦੇ ਹਨ ਇਸ ਲਈ ਪਹਿਲੇ ਦਿਨ ਤੋਂ ਹੀ ਯੋਗੇ ਦੇ ਪੱਕੇ ਟ੍ਰੈਨਰ ਹੋਣੇ ਚਾਹੀਦੇ ਹਨ ਉਸ ਕੋਲ ਹੀ ਸਾਨੁੂੰ ਇਸਦੀ ਸਿਖਲਾਈ ਲੈਣੀ ਚਾਹੀਦੀ ਹੈ ਪ੍ਰੋਪਰ ਸਿਖਲਾਈ ਤੋਂ ਬਿਨਾਂ ਸਾਨੂੰ ਇਹ ਯੋਗਾ ਸ ਸ਼ੁਰੂ ਨਹੀਂ ਕਰਨਾ ਚਾਹੀਦਾ ਅਤੇ ਪਹਿਲੇ ਦਿਨ ਤੋਂ ਯੋਗਾ ਹਲਕੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਲੈ ਕੇ ਜਾਣਾ ਹੁੰਦਾ ਕਿਉਂਕਿ ਕਈ ਵਾਰ ਲੋਕ ਅਜਿਹਾ ਕਰਦੇ ਹਨ ਕਿ ਉਹ ਪਹਿਲੇ ਦਿਨ ਤੋਂ ਹੀ ਬੜਾ ਭਾਰੀ ਯੋਗਾ ਕਰਨ ਲੱਗ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਉਠਾਉਣਾ ਪੈ ਜਾਂਦਾ ਇਸ ਲਈ ਤੁਸੀਂ ਵੱਖ ਵੱਖ ਚੈਨਲ ਰਾਹੀਂ ਯੋਗਾ ਦਾ ਅਭਿਆਸ ਕਰੋ ਉਸ ਤੋਂ ਬਾਅਦ ਹੀ ਉਸਨੂੰ ਪ੍ਰੈਕਟੀਕਲ ਤੋਰ 'ਤੇ ਲਾਗੂ ਕਰੋ